ਮੇਰੀਆਂ ਪਸੰਦ ਦੀਆਂ ਸ਼ੈਲੀਆਂ ਹਨ ਮਕੈਨੀਕਲ ਇੰਜੀਨੀਅਰਿੰਗ ਜਿਹੜਾ ਮੇਰਾ ਕਿ ਇੱਕ ਮੇਰਾ ਵਿਸ਼ਾ ਹੈ ਜਿਹਦੇ ਵਿੱਚ ਮੈਂ ਡਿਗਰੀ ਪ੍ਰਾਪਤ ਕੀਤੀ ਹੈ ਉਹਦੇ ਵਿੱਚ ਦਸ ਪੰਦਰ੍ਹਾਂ ਕਿਤਾਬਾਂ ਹਨ ਜਿਵੇਂ ਕਿ ਸਟਰੈਂਥ ਔਫ ਮਟੀਰੀਅਲ ਇੱਕ ਕਿਤਾਬ ਹੈ ਥਿਊਰੀ ਔਫ ਮਸ਼ੀਨਸ ਹੈ ਮਸ਼ੀਨ ਡਿਜ਼ਾਇਨ ਹੈ ਮਸ਼ੀਨ ਡਰਾਇੰਗ ਹੈ ਇੰਜੀਨੀਅਰਿੰਗ ਡਰਾਇੰਗ ਹੈ ਐਲੀਮੈਂਟਸ ਔਫ ਮਕੈਨੀਕਲ ਇੰਜੀਨੀਅਰ ਬਹੁਤ ਸਾਰੀਆਂ ਕਿਤਾਬਾਂ ਹਨ ਜਿਹਦੇ ਵਿੱਚ ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਪੜ੍ਹਦੇ ਹਾਂ ਅਤੇ ਫਿਰ ਬੱਚਿਆਂ ਨੂੰ ਪੜ੍ਹਾਉਂਦੇ ਹਾਂ ਇਹਦੇ ਵਿੱਚੋਂ ਇੱਕ ਜਿਹੜਾ ਵਿਸ਼ਾ ਹੈ ਇੰਜੀਨੀਅਰਿੰਗ ਡਰਾਇੰਗ ਜਿਹੜਾ ਕਿ ਅਸੀਂ ਲਗਾਤਾਰ ਪਿਛਲੇ ਪੰਦਰ੍ਹਾਂ ਸਾਲ ਤੋਂ ਪੜ੍ਹਦੇ ਆਉਂਦੇ ਹਾਂ ਅਤੇ ਇਹਨੂੰ ਪੜ੍ਹਾਉਂਦੇ ਆ ਰਹੇ ਹਾਂ ਇਹਦੇ ਇਹਦੇ ਵਿੱਚ ਬਹੁਤ ਜ਼ਿਆਦਾ ਰੁਚੀ ਹੈ ਇਹ ਕਿਤਾਬ ਮੈਂ ਹਾਲ ਹੀ ਵਿੱਚ ਵੀ ਹੁਣ ਪੜ੍ਹੀ ਹੈ ਅਤੇ ਮੈਨੂੰ ਹਲੇ ਵੀ ਉਨੀ ਚੰਗੀ ਲੱਗਦੀ ਹੈ ਜਿਹੜੇ ਕਿ ਮੈਂ ਦਸ ਸਾਲਾਂ ਪਹਿਲਾਂ ਇਹਨਾਂ ਨੂੰ ਪੜ੍ਹਿਆ ਕਰਦਾ ਸੀ ਇਹ ਵੀ ਇਹਦੇ ਵਿੱਚ ਬਹੁਤ ਹੀ ਸੁਚਾਰੂ ਢੰਗ ਨਾਲ ਸਮਝਾਇਆ ਜਾਂਦਾ ਹੈ ਅਤੇ ਬੱਚਿਆਂ ਨੂੰ ਪ੍ਰੈਕਟੀਕਲ ਹੋ ਕੇ ਵੀ ਇਹਦੇ ਵਿੱਚ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਅਤੇ ਇਹ ਕਿਤਾਬ ਮੇਰੇ ਦਿਲ ਦੇ ਬੜੀ ਕਰੀਬ ਹੈ ਅਤੇ ਮੈਂ ਇਹ ਵਿਸ਼ਾ ਅੱਗੇ ਤੋਂ ਵੀ ਆਪਣੀ ਜ਼ਿੰਦਗੀ ਵਿੱਚ ਇਹਨੂੰ ਵੱਧ ਵੱਧ ਚੜ੍ਹ ਕੇ ਪੜ੍ਹਨਾ ਚਾਹੁੰਦਾ ਹਾਂ